ਪਿੰਡਾਂ 'ਚ ਸਭ ਤੋਂ ਪਹਿਲਾਂ ਜਦੋਂ ਵਿਆਹ ਦੀ ਤਿਆਰੀ ਹੁੰਦੀ ਹੈ ਤਾਂ ਘਰ ਦੀਆਂ ਸਫਾਈਆਂ ਹੁੰਦੀਆਂ ਨੇ ਪੇਂਟ ਕੀਤਾ ਜਾਂਦਾ ਉਸ ਤੋਂ ਬਾਅਦ ਕਾਰਡ ਵਗੈਰਾ ਵਗੈਰਾ ਛਪਾਏ ਜਾਂਦੇ ਨੇਗੇ ਫਿਰ ਉਹਨਾਂ ਨੂੰ ਹਰ ਇੱਕ ਘਰ ਵਿੱਚ ਜਾ ਕੇ ਦਿੱਤਾ ਜਾਂਦਾ ਰਿਸ਼ਤੇਦਾਰਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇਗੀਆਂ ਫਿਰ ਇਸ ਤੋਂ ਬਾਅਦ ਕੀ ਹੁੰਦਾ ਵਿਆਹ ਦੀ ਤਿਆਰੀ ਆ ਜਾਂਦੀ ਆ ਜਿੱਦੇ ਕੜਾਹੀ ਹੁੰਦੀ ਹੈਗੀ ਉਸ ਦਿਨ ਲੱਡੂ ਵਗੈਰਾ ਵੱਟੇ ਜਾਂਦੇ ਨੇਗੇ ਹੋਰ ਮਿਠਾਈਆਂ ਬਣਾਈਆਂ ਜਾਂਦੀਆਂ ਨੇਗੀਆਂ ਫਿਰ ਉਸ ਤੋਂ ਤੁਹਾਨੂੰ ਰੋਟੀ ਦਾ ਪ੍ਰੋਗਰਾਮ ਹੁੰਦਾ ਰੋਟੀ 'ਤੇ ਆਪਾਂ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹੈਗੇ ਸ਼ਾਮ ਨੂੰ ਮਤਲਬ ਕਿ ਡੀ ਜੇ ਵਗੈਰਾ ਦਾ ਪ੍ਰੋਗਰਾਮ ਹੁੰਦਾ ਬਟਨੇ ਵਗੈਰਾ ਲਾਏ ਜਾਂਦੇ ਨੇਗੇ ਅਤੇ ਨੱਚਿਆ ਵਗੈਰਾ ਜਾਂਦਾ ਗਾ ਉਸ ਤੋਂ ਅਗਲੇ ਦਿਨ ਜਿਸ ਦਿਨ ਬਰਾਤ ਆਉਂਦੀ ਹੈ ਬਰਾਤ 'ਤੇ ਆਪਾਂ ਜੋ ਜੇ ਮੁੰਡੇ ਦੀ ਜਾਂਦੀ ਹੋਵੇ ਚਾਹੇ ਆਉਣੀ ਹੋਵੇ ਪੈਲਸ 'ਚ ਪ੍ਰਬੰਧ ਕੀਤਾ ਹੁੰਦਾ ਹੈਗਾ ਸਭ ਤੋਂ ਪਹਿਲਾਂ ਮਿਲਣੀ ਹੁੰਦੀ ਹੈ ਮਿਲਣੀ ਜਿਵੇਂ ਪਹਿਲੇ ਆਪਣੇ ਮੰਮੀ ਮੰਮੀ ਦੀ ਪਾਪਾ ਦੀ ਮਿਲਣੀ ਹੋਵੇਗੀ ਉਸ ਤੋਂ ਬਾਅਦ ਮਾਮਿਆਂ ਦੀ ਮਿਲਣੀ ਹੋ ਗਈ ਮਾ ਮਾਸੜਾਂ ਦੀ ਮਿਲਣੀ ਹੋ ਗਈ ਸਭ ਦੀ ਮਿਲਣੀ ਕਰਵਾਈ ਜਾਂਦੀ ਹੈ ਮੁਲਾਕਾਤ ਹੋ ਜਾਂਦੀ ਹੈ ਇੱਕ ਦੂਜੇ ਨਾਲ ਉਸ ਤੋਂ ਬਾਅਦ ਜਿਹੜਾ ਪ੍ਰਬੰਧ ਕੀਤਾ ਹੁੰਦਾ ਹੈਗਾ ਪ੍ਰਬੰਧ ਤੋਂ ਬਾਅਦ ਜੋ ਆਪਣੀ ਵਰੀ ਵਗੈਰਾ ਦੇਖਣੀ ਹੁੰਦੀ ਹੈ ਮੀਟਿੰਗ ਹੁੰਦੀ ਹੈਗੀ ਗੀ ਗੋਲਡ ਪਾਇਆ ਵਾ ਕੁਛ ਵੀ ਪਾਇਆ ਹੈਗਾ ਫਿਰ ਉਹ ਚੀਜ਼ ਮਤਲਬ ਕਿ ਉਹਨਾਂ ਨੂੰ ਦਿਖਾਈ ਜਾਂਦੀ ਹੈਗੀ ਮੀਟਿੰਗ ਦੌਰਾਨ ਕਿ ਆਪਾਂ ਨੇ ਕੀ ਦਿੱਤਾ ਵਾ ਕੀ ਨਹੀਂ ਦਿੱਤਾ ਵਾ ਇਹ ਚੀਜ਼ ਵ